ਜੀ ਹਾਂ ਗਰੀਬੀ ਚੰਗੀ ਡਾਕਟਰ ਦੀ ਦੇਖਭਾਲ ਤੱਕ ਪਹੁੰਚਣ ਵਿੱਚ ਬਹੁਤ ਵੱਡੀ ਰੁਕਾਵਟ ਹੈ ਲੇਕਿਨ ਸਰਕਾਰ ਨੇ ਅੱਜ ਦੇ ਟਾਇਮ 'ਚ ਸਾਡੇ ਨੀਲੇ ਕਾਰਡ ਵਗੈਰਾ ਹੋਰ ਸਿਹਤ ਸੇਵਾਵਾਂ ਬਹੁਤ ਜ਼ਿਆਦਾ ਦੇ ਦਿੱਤੀਆਂ ਹਨ ਜਿਨ੍ਹਾਂ ਨਾਲ ਗਰੀਬ ਲੋਕਾਂ ਤੱਕ ਵਧੀਆ ਇਲਾਜ ਪਹੁੰਚਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਬਹੁਤ ਲਾਭ ਮਿਲ ਰਹੇ ਹਨ ਇਸ ਕਰਕੇ ਇਹ ਸਹੂਲਤਾਂ ਦਾ ਸਾਨੂੰ ਵੱਧ ਤੋਂ ਵੱਧ ਲਾਭ ਲੈਣਾ